ਨੌਜਵਾਨ ਵਰਗ ਅੱਜ ਕੱਲ੍ਹ ਕੰਮ ਆਪਣੇ ਹੱਥਾਂ ਨਾਲ ਕਰਦੇ ਹਨ ਜੋ ਵੀ ਖੇਤੀ ਦਾ ਕੰਮ ਹੈ ਵੈਸੇ ਤਾਂ ਗੌਰਮੈਂਟ ਨੇ ਹਰ ਸੰਦ ਇਸਤੇਮਾਲ ਕਰਨ ਵਾਸਤੇ ਪਿੰਡਾਂ ਦੇ ਵਿੱਚ ਬਹੁਤ ਭੇਜ ਰੱਖੇ ਹਨ ਪਰ ਫੇਰ ਵੀ ਜੋ ਜਿਵੇਂ ਵੱਟਾਂ ਵੁੱਟਾਂ ਬਣਾਉਣੀਆਂ ਘੜਨੀਆਂ ਜਾਂ ਹਰੇ ਪੱਠੇ ਵੱਢ ਕੇ ਲਿਆਉਣੇ ਜਾਂ ਕਰਨੇ ਇਹ ਵੀ ਆਪਣੇ ਹੱਥਾਂ ਨਾਲ ਹੀ ਕੰਮ ਕਰਦੇ ਹਨ ਜੇ ਕੋਈ ਖਾਦ ਵਗੈਰਾ ਆਪਣੇ ਖੇਤਾਂ ਦੇ ਵਿੱਚ ਪਾਉਣੀ ਹੈ ਤਾਂ ਵੀ ਆਪਣੇ ਟਰੈਕਟਰ ਟਰਾਲੀ ਨਾਲ ਆਪਣੇ ਹੱਥਾਂ ਨਾਲ ਹੀ ਉਸਨੂੰ ਜਾ ਕੇ ਪਾਉਂਦੇ ਹਨ ਅਤੇ ਖਿਲਾਰਦੇ ਹਨ ਜੇ ਵੈਸੇ ਅੱਜ ਕੱਲ੍ਹ ਮਸ਼ੀਨਰੀ ਦਾ ਯੁੱਗ ਹੈ ਜੋ ਵੀ ਕਣਕ ਵਢਾਈ ਕਢਾਈ ਢੁਆਈ ਜੋ ਵੀ ਹੈ ਸਭ ਮਸ਼ੀਨਰੀ ਰਾਹੀਂ ਹੁੰਦਾ ਹੈ ਪਰ ਫੇਰ ਵੀ ਤੂੜੀ ਵਗੈਰਾ ਦਾ ਕੰਮ ਜਿਹੜਾ ਹੈ ਉਹ ਨੌਜਵਾਨ ਆਪਣੇ ਹੱਥਾਂ ਨਾਲ ਹੀ ਕਰਦੇ ਹਨ ਜਿਨ੍ਹਾਂ ਨੂੰ ਅ ਆਪਣੀ ਤੂੜੀ ਵਗੈਰਾ ਬਣਾਉਣੀ ਹੁੰਦੀ ਹੈ ਬਣਾ ਕੇ ਆਪਦੇ ਘਰ ਲਿਆਉਣੀ ਹੁੰਦੀ ਹੈ ਫੇਰ ਵੀ ਉਹ ਆਪਦੇ ਹੱਥਾਂ ਨਾਲ ਹੀ ਉਸ ਨੂੰ ਅੰਦਰ ਪੈ ਭਰਾਈ ਕਰਦੇ ਹਨ ਬਾਕੀ ਰਹੀ ਮਸ਼ੀਨਰੀ ਦੀ ਗੱਲ ਜਿਵੇਂ ਬਿਜਾਈ ਵਾਲੀ ਮਸ਼ੀਨਾਂ ਅਤੇ ਕਣਕ ਕਢਾਈ ਵਾਲੀ ਮਸ਼ੀਨਾਂ ਵਢਾਈ ਵਾਲੀਆਂ ਮਸ਼ੀਨਾਂ ਝੋਨਾ ਵੱਢਣ ਵਾਲੀਆਂ ਝੋਨਾ ਲਾਉਣ ਵਾਲੀਆਂ ਮਸ਼ੀਨਾਂ ਵੀ ਨਵੀਆਂ ਤਕਨੀਕਾਂ ਦੇ ਨਾਲ ਅਪਣਾ ਰਹੇ ਹੈ ਜੇ ਉਹਨਾਂ ਦੇ ਨਾਲ ਅਸੀਂ ਆਪਣੇ ਨੌਜਵਾਨ ਇਸਤੇਮਾਲ ਕਰਨ ਦਾ ਤਰੀਕਾ ਜਾਣਦੇ ਹਨ ਤਾਂ ਬਹੁਤ ਹੀ ਸਹੂਲਤ ਹੈ ਇਸ ਮਸ਼ੀਨਰੀ ਦੇ ਯੁੱਗ ਵਿੱਚ ਜੇ ਕੋਈ ਆਦਮੀ ਆਪਣੇ ਖੇਤ ਦੀ ਜਾਂ ਆਸੇ ਪਾਸੇ ਕੋਈ ਵੱਟਾਂ ਡੋਲਾਂ ਦਾ ਕੰਮ ਕਰਦਾ ਹੈ ਤਾਂ ਉਹ ਆਪਦੇ ਹੱਥੀਂ ਕਰਦਾ ਹੈ